ਮੈਨੂੰ ਗਲਪ ਨਹੀਂ ਗੈਰ ਗਲਪ ਲਿਖਣਾ ਪਸੰਦ ਹੈ ਕਿਉਂਕਿ ਗੈਰ ਗਲਪ ਦਾ ਮਤਲਬ ਹੈ ਆਪਣੀ ਹਕੀਕਤ ਦੇ ਵਿੱਚ ਲਿਖਣਾ ਆਪਣੇ ਆਪ ਬੀਤੀ ਹੋਈ ਹੱਡਬੀਤੀ ਨੂੰ ਲਿਖਣਾ ਇਹ ਪਸੰਦ ਹੈ ਅਤੇ ਮੇਰਾ ਮਨ ਪਸੰਦ ਕਵੀ ਬਾਬਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਬਾਬਾ ਬੁੱਲੇ ਸ਼ਾਹ ਸ਼ਿਵ ਕੁਮਾਰ ਬਟਾਲਵੀ ਨਾਨਕ ਸਿੰਘ ਬਹੁਤ ਲੇਖਕ ਨੇ ਜਿਹੜੇ ਮੇਰੇ ਹਰਮਨ ਪਿਆਰੇ ਨੇ ਮੈਂ ਉਹਨਾਂ ਤੋਂ ਸਿੱਖਿਆ ਇਹ ਹੈ ਕਿ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਸੀ ਜਿਹੜੇ ਉਹਨਾਂ ਦੇ ਰੂਲ ਸੀ ਜਿਹੜੇ ਉਹਨਾਂ ਦੇ ਕਾਨੂੰਨ ਸੀ ਜਿਹੜੀਆਂ ਉਹਨਾਂ ਦੀਆਂ ਸਿੱਖਿਆਵਾਂ ਸੀ ਉਹਨਾਂ ਦੇ ਨਾਲ ਮੈਂ ਮੈਨੂੰ ਪ੍ਰਭਾਵਿਤ ਕੀਤਾ ਮੈਂ ਉਹਨਾਂ ਤੋਂ ਪ੍ਰਭਾਵਿਤ ਹਾਂ

ਬਾਕੀ ਬਾਬੇ ਨਾਨਕ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਨੇ ਤਾਂ ਸਰੀਰ ਦੇ ਧੜ੍ਹ ਤੋਂ ਉੱਪਰਲੀਆਂ ਉੱਪਰਲੀਆਂ ਗੱਲਾਂ ਹੀ ਕੀਤੀਆਂ